ਪੰਜਾਬੀ ਸੱਭਿਆਚਾਰ ਪਿਆਰ ਦਾ ਭਰਿਆ ਹੋਇਆ ਹੈ ਇੱਥੋਂ ਦੇ ਜੋ ਲੋਕ ਹੈ ਪਰਿਵਾਰਕ ਮੈਂਬਰ ਇੱਕ ਦੂਜੇ ਨਾਲ਼ ਮਿਲ ਕੇ ਰਹਿੰਦੇ ਹਨ ਅਤੇ ਜੇਕਰ ਮੈਂ ਗੱਲ ਕਰਾਂ ਲਿੰਗ ਸਮਾਨਤਾ ਦੀ ਤਾਂ ਇੱਥੇ ਕੁੜੀ ਜਾਂ ਮੁੰਡੇ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਅੱਜ ਕੱਲ੍ਹ ਕੁੜੀਆਂ ਅਤੇ ਮੁੰਡੇ ਦੋਨਾਂ ਨੂੰ ਬਰਾਬਰ ਹੀ ਸਮਝਿਆ ਜਾਂਦਾ ਪੜ੍ਹਾਈ ਦੇ ਖੇਤਰ ਵਿੱਚ ਹੋਵੇ ਜਾਂ ਫਿਰ ਨੌਕਰੀਆਂ ਜਾਂ ਕੁਝ ਵੀ ਹੋਵੇ ਦੋਨਾਂ ਨੂੰ ਇੱਕੋ ਬਰਾਬਰ ਟ੍ਰੀਟ ਕੀਤਾ ਜਾਂਦਾ ਕੁੜੀਆਂ ਲਈ ਵੀ ਬਹੁਤ ਸਹੂਲਤਾਂ ਅਤੇ ਮੁੰਡਿਆਂ ਲਈ ਵੀ ਬਹੁਤ ਸਹੂਲਤਾਂ ਏ ਆ ਸਾਰਿਆਂ ਨੂੰ ਬਰਾਬਰ ਹੀ ਸਮਝਿਆ ਜਾਂਦਾ ਹੈ ਪੰ